ਹੈਲੋ ਕਸਟਮਰ ਕੇਅਰ ਐਮਾਜੋਨ ਮੈਂ ਅੰਮ੍ਰਿਤਪਾਲ ਸਿੰਘ ਮੈਂ ਘੜੀ ਓਡਰ ਕੀਤੀ ਸੀ ਜੋ ਕਿ ਮੈਨੂੰ ਬਹੁਤ ਜਲਦੀ ਐਮਾਜੋਨ ਤੋਂ ਮਿਲੀ ਅਤੇ ਬਹੁਤ ਜਲਦੀ ਇਹਦਾ ਪਰਸੈਸ ਹੋਇਆ ਮੈਂ ਕਾਫ਼ੀ ਦਿਨ ਤੋਂ ਵੇਟ ਕਰ ਰਿਹਾ ਸੀ ਕਿ ਟੈਮ ਲੱਗੇਗਾ ਪਰ ਮੈਨੂੰ ਇਹ ਘੜੀ ਬਹੁਤ ਜਲਦੀ ਮਿਲ ਗਈ ਅਤੇ ਕਿਉਂਕਿ ਔਫਿਸ ਵਗੈਰਾ ਵਿੱਚ ਸਾਰਿਆਂ ਦੇ ਵੋਚ ਪਾਈ ਹੁੰਦੀ ਸੀ ਕਿ ਸਮਾਟ ਵੋਚ ਅਤੇ ਮੈਨੂੰ ਵੀ ਲੱਗਦਾ ਸੀ ਕਿ ਮੇਰੇ ਕੋਲ ਵੀ ਸਮਾਟ ਵੋਚ ਹੋਵੇ ਅਤੇ ਮੈਂ ਕਾਫ਼ੀ ਦੇਰ ਤੋਂ ਫਲਿਪਕਾਟ 'ਤੇ ਅੋਰ ਜਗ੍ਹਾ 'ਤੇ ਵੀ ਟਰਾਈ ਕਰ ਰਿਹਾ ਸੀਗਾ ਕਿ ਮੈਨੂੰ ਵਧੀਆ ਮਿਲ ਜਾਵੇ ਪਰ ਮੈਨੂੰ ਉਹਨਾਂ ਦਾ ਬਜਟ ਬਹੁਤ ਜ਼ਿਆਦਾ ਮਿਲ ਰਿਹਾ ਸੀ ਅਤੇ ਫ ਐਮਾਜੋਨ 'ਤੇ ਬਹੁਤ ਘੱਟ ਬਜਟ ਸੀਗਾ ਇਸ ਕਰਕੇ ਮੈਂ ਐਮਾਜੋਨ ਤੋਂ ਟਰਾਈ ਕੀਤੀ ਅਤੇ ਘਰ ਵਿੱਚ ਇੱਕ ਮੈਰਿਜ ਆ ਰਹੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੈਂ ਵੀ ਸਮਾਟ ਵੋਚ ਖਰੀਦਾਂ ਫਿਰ ਮੈਂ ਸਮਾਟ ਵੋਚ ਲਈ ਐਮਾਜੋਨ 'ਤੇ ਦੇਖਿਆ ਅਤੇ ਮੈਨੂੰ ਕਾਫ਼ੀ ਸਸਤੀ ਮਿਲ ਰਹੀ ਸੀ ਅਤੇ ਮੈਂ ਐਮਾਜੋਨ ਤੋਂ ਖਰੀਦਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਰਿਆਂ ਦੇ ਐਮ ਓਫਿਸ ਵਗੈਰਾ ਵਿੱਚ ਸਮਾਟ ਵੋਚ ਪਾਈ ਹੁੰਦੀ ਸੀ ਮੈਨੂੰ ਵੀ ਕਾਫ਼ੀ ਚਿਰ ਤੋਂ ਇਹ ਸੀ ਕਿ ਮੈਂ ਵੀ ਸਮਾਟ ਵੋਚ ਲਵਾਂ ਅਤੇ ਸਮਾਟ ਵੋਚ ਦੇ ਵਿੱਚ ਕਾਫ਼ੀ ਓਪਸ਼ਨਸ ਸੀਗੀਆਂ ਅਤੇ ਬਹੁਤ ਵਧੀਆ ਲੱਗੀ ਮੈਨੂੰ ਕਿਉਂਕਿ ਬਹੁਤ ਜਲਦੀ ਇਹਨਾਂ ਦੀ ਪ੍ਰਸੈਸਿੰਗ ਸੀ ਅਤੇ ਇਹ ਜਦੋਂ ਮੇਰੇ ਕੋਲ ਦੋ ਤਿੰਨ ਦਿਨਾਂ ਵਿੱਚ ਆ ਗਈ ਅਤੇ ਮੈਂ ਇਸਨੂੰ ਖੋਲ੍ਹ ਕੇ ਦੇਖਿਆ ਇਹ ਚੰਗੀ ਤਰ੍ਹਾਂ ਕਵਰ ਕੀਤੀ ਹੋਈ ਸੀ ਮਤਲਬ ਕੋਈ ਇਹ 'ਤੇ ਸਕਰੈਚ ਵਗੈਰਾ ਨਹੀਂ ਸੀ ਅਤੇ ਸਮਾਟ ਵੋਚ ਮੇਰੇ ਹਾਟ ਬੀਟ ਬਾਰੇ ਜਾਂ ਕੁਛ ਪਾਣੀ ਵੀ ਵਗੈਰਾ ਪੀਨਾ ਮੈਂ ਉਸ ਬਾਰੇ ਵੀ ਮੈਨੂੰ ਸਾਰਾ ਕੁਛ ਮੈਨੂੰ ਪ੍ਰੋਪਰ ਦੱਸਦੀ ਹੈ ਇਸ ਵਿੱਚ ਬਹੁਤ ਸਾਰੀਆਂ ਓਪਸ਼ਨ ਹੈ ਫ਼ੰਕਸ਼ਨ ਹੈ ਬਹੁਤ ਜ਼ਿਆਦਾ ਓਪਸ਼ਨ ਹੈਗੀਆਂ ਹੈ ਅਤੇ ਮੈਂ ਸਾਰਿਆਂ ਨੂੰ ਇਹ ਹੀ ਰਾਏ ਦਿੰਦਾ ਕਿ ਸਾਰੇ ਜਣੇ ਸਮਾਟ ਵੋਚ ਖਰੀਦੋ ਲਓ ਇਹਦੇ ਬਹੁਤ ਫ਼ਾਇਦੇ ਹੈ ਕਿਉਂਕਿ ਮੈਂ ਸਨਾਟਾ ਕੰਪਨੀ ਦੀ ਖਰੀਦੀ ਸੀ ਇਹ ਕੰਪਨੀ ਮੈਨੂੰ ਕਾਫ਼ੀ ਵਧੀਆ ਲੱਗੀ ਅਤੇ ਮੇਰੇ ਕੋਲ ਇਹ ਵੋਚ ਕਾਫ਼ੀ ਚਿਰ ਤੋਂ ਚੱਲ ਰਹੀ ਹੈ ਇਸ ਵਿੱਚ ਕੋਈ ਵੀ ਹਜੇ ਤੱਕ ਪ੍ਰੋਬਲਮ ਨਹੀਂ ਆਏਗੀ ਬਹੁਤ ਵਧੀਆ ਹੈ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਦੋਸਤਾਂ ਨੂੰ ਕਿ ਸਮਾਟ ਵੋਚ ਖਰੀਦੋ ਐਮਾਜੋਨ ਤੋਂ ਕਿਉਂਕਿ ਇਹ ਬਹੁਤ ਵਧੀਆ ਹੈ ਪ੍ਰਸੈਸਿੰਗ ਹੈ ਇਹਨਾਂ ਦੀ ਜੋ ਐਮਾਜੋਨ ਵਾਲੇ ਸਭ ਤੋਂ ਜਲਦੀ ਪ੍ਰਸੈਸ ਕਰ ਦਿੰਦੇ ਨੇ ਮੈਂ ਤਾਂ ਕਾਫ਼ੀ ਚਿਰ ਤੋਂ ਵੇਟ ਕਰ ਰਿਹਾ ਸੀ ਕਿ ਤਿੰਨ ਚਾਰ ਦਿਨ ਲੱਗ ਜਾਣ ਹਫ਼ਤਾ ਲੱਗੇਗਾ ਪਰ ਮੈਨੂੰ ਜਲਦੀ ਤਿੰਨ ਚਾਰ ਦਿਨਾਂ ਵਿੱਚ ਇਹ ਵੋਚ ਮੈਨੂੰ ਜੋ ਕਿ ਮੈਨੂੰ ਮਿਲ ਗਈ ਸੀ